ਸਤਿ ਸ਼੍ਰੀ ਅਕਾਲ ਜੀ ਤੁਸੀਂ ਸੈਣੀ ਢਾਬਾ ਤੋਂ ਗੱਲ ਕਰ ਰਹੇ ਹੋ ਹਾਂਜੀ ਸਰ ਮੈਂ ਕੁਛ ਨਾ ਆਈਟਮਾਂ ਮੰਗਵਾਉਣੀਆਂ ਸੀ ਖਾਣ ਦੀਆਂ ਹਾਂਜੀ ਹਾਂਜੀ ਪੀਜ਼ਾ ਇੱਕ ਪੀਜ਼ਾ ਕਰਵਾਉਣਾ ਸੀ ਥੋਤੋ ਹਾਂਜੀ ਫਾਮ ਹਾਊਸ ਪੀਜ਼ਾ ਠੀਕ ਹੈ ਅਤੇ ਤੁਹਾਡੇ ਕੋਲ਼ੋ ਆਪਣਾ ਗ੍ਰਿੱਲਡ ਸੈੈਡਵਿੱਚ ਹੋਏਗੀ ਦੋ ਗ੍ਰਿੱਲਡ ਸੈਡਵਿੱਚ ਕਰ ਦਿਉ ਠੀਕ ਹੈ ਜੀ ਅਤੇ ਦੋ ਬਰਗਰ ਕਰ ਦਿਉ ਨਹੀਂ ਸਿੰਪਲ ਬਰਗਰ ਵੈੱਜ਼ਈ ਵਾਲੇ ਠੀਕ ਹੈ ਜੀ ਅਤੇ ਫਰਾਇਜ਼ ਵੀ ਹੋਣਗੇ ਤੁਹਾਡੇ ਕੋਲ਼ ਠੀਕ ਹੈ ਇੱਕ ਪਲੇਟ ਕਰ ਦਿਉ ਇੱਕ ਫਰਾਇਜ਼ ਦਾ ਕਰ ਦਿਉ ਇੱਕ ਪੈਕ ਅਤੇ ਆਪਣਾ ਤੁਹਾਡੇ ਕੋਲ਼ੇ ਜਿਹੜਾ ਪੀਜ਼ਾ ਕਰੂੰਗੇ ਹਾਂਜੀ ਲਾਰਜ ਵਾਲਾ ਵੱਡੇ ਵਾਲਾ ਕਰ ਦਿਉ ਇੱਕ ਠੀਕ ਹੈ ਅਤੇ ਜਿਹੜਾ ਪੀਜ਼ਾ ਹੈ ਇਹਦੇ ਵਿੱਚ ਮੈਨੂੰ ਐਕਸਟਰਾਂ ਚੀਜ਼ ਚਾਹੀਦੀ ਸੀ ਠੀਕ ਹੈ ਕੋਈ ਅਲੱਗ ਤੋਂ ਹੋਰ ਅਲੱਗ ਤੋਂ ਸ ਸੋਸ ਵੀ ਐਡ ਹੋ ਸਕਦੀ ਹੈ ਇਸ ਵਿੱਚ ਠੀਕ ਹੈ ਨਹੀਂ ਨਹੀਂ ਇਹਦੇ ਚਾਰਜਿਸ ਅਲੱਗ ਹੋਣਗੇ ਜਾਂ ਇਹਨੂੰ ਨਾਲ਼ ਮਤਲਬ ਵੈਸੇ ਐਕਸਟ੍ਰਾ ਦੇ ਦਿਉਂਗੇ ਐਡੀਸ਼ਨਲ ਠੀਕ ਹੈ ਜੀ ਠੀਕ ਹੈ ਬਰਗਰ ਹਾਂਜੀ ਦੋਨੋਂ ਗ੍ਰਿੱਲਡ ਬਰਗਰ ਸੈਡਵਿੱਚ ਵੀ ਦੋਨੋਂ ਗ੍ਰਿੱਲਡ ਵੈੱਜ਼ ਸੈਡਵਿੱਚ ਦੋ ਠੀਕ ਹੈ ਜੀ ਅਤੇ ਆਪਣਾ ਤੁਹਾਡਾ ਜਿਹੜਾ ਹੈਗਾ ਏ ਸਿਸਟਮ ਪੁੱਛਣਾ ਸੀ ਵੀ ਕਿਵੇਂ ਕਰਦੇ ਹੋ ਤੁਸੀਂ ਇਹ ਆਪਣਾ ਡਿਲਵਲੀ ਵਗੈਰਾ ਕਿਵੇਂ ਕਰਦੇ ਹੋ ਸਵੀਗੀ ਏ ਜਮੇਟੋ ਵਗੈਰਾ ਦੇ ਥਰੂ ਕਰਨਾ ਪਏਗਾ ਔਡਰ ਤੁਹਾਡਾ ਜਾਂ ਜਿਵੇਂ ਹੁਣ ਮੈਂ ਫੋਨ 'ਤੇ ਹੀ ਔਡਰ ਦੇ ਰਹੀ ਹਾਂ ਤੁਸੀਂ ਇਵੇਂ ਹੀ ਕਰ ਦੇਵੋਂਗੇ ਠੀਕ ਹੈ ਜੀ ਖ਼ੁਦ ਦਾ ਡਿਲਵਰੀ ਬੋਆਏ ਹੈਗਾ ਠੀਕ ਹੈ ਬਿਲਕੁਲ ਹਾਂਜੀ ਹਾਂਜੀ ਤੁਹਾਡੇ ਨੇੜੇ ਹੀ ਹੈ ਮੈਂ ਐਡਰੈਸ ਤੁਹਾਨੂੰ ਮੈਸਿਜ਼ ਕਰ ਦਿੰਦੀ ਹਾਂ ਹਾਂਜੀ ਠੀਕ ਹੈ ਅਤੇ ਆਪਣਾ ਪੇਮੈਂਟ ਦਾ ਕਿਵੇਂ ਹੈ ਤੁਹਾਡਾ ਠੀਕ ਹੈ ਕੈਸ਼ ਔਰ ਗੂਗਲ ਪੇ ਦੋਨੋਂ ਲੈ ਲੈਂਦੇ ਹੋ ਹੈ ਨਾ ਇਸ ਨੰਬਰ 'ਤੇ ਗੂਗਲ ਪੇ ਹੋ ਜਾਵੇਗਾ ਠੀਕ ਹੈ ਮੈਂ ਤੁਹਾਨੂੰ ਗੂਗਲ ਪੇ ਕਰ ਦੇਵਾਂਗੀ ਅਤੇ ਕਿੰਨਾ ਕੁ ਟਾਇਮ 'ਚ ਔਡਰ ਕੰਪਲੀਟ ਹੋ ਜਾਵੇਗਾ ਮੇਰਾ ਮੈਨੂੰ ਕਦ ਮਿਲ ਜਾਵੇਗਾ ਅੱਧਾ ਘੰਟਾ ਠੀਕ ਹੈ ਜੀ ਔਰ ਆਪਣਾ ਠੀਕ ਹੈ ਐਡਰੈਸ ਮੈਂ ਤੁਹਾਨੂੰ ਸੈਂਡ ਕਰ ਦਿੰਦੀ ਹਾਂ ਬਿਲਕੁਲ ਬਿਲਕੁਲ ਔਨ ਦੀ ਰੋਡ ਹੀ ਹੈ ਠੀਕ ਹੈ ਸਰ ਅਤੇ ਠੀਕ ਹੈ ਜੀ ਅਤੇ ਐਕਸਟ੍ਰਾ ਚੀਜ਼ ਜ਼ਰੂਰ ਪਾ ਦਿਉ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ